ਕਾਰੋਬੇ ਕਾਰੋਬਾਰ ਵਿੱਚ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਜੋ ਵੀ ਕੋਈ ਮਨ ਲਗਾ ਕੇ ਕੰਮ ਕਰਦਾ ਹੈ ਉਸ ਨੂੰ ਉਸ ਤਰ੍ਹਾਂ ਦਾ ਹੀ ਕੰਮ ਦਿੱਤਾ ਜਾਂਦਾ ਹੈ ਜਿਹੜਾ ਕੋਈ ਪੜ੍ਹਿਆ ਲਿਖਿਆ ਹੈ ਉਹ ਪੜ੍ਹਿਆ ਲਿਖਿਆ ਵਾਲਾ ਕੰਮ ਕਰਨ ਕਰ ਲੈਂਦਾ ਹੈ ਜਿਹੜਾ ਕੋਈ ਕੰਬਾਈਨਾਂ ਵਿੱਚ ਬਣਾਉਂਦਾ ਹੈ ਜਾਂ ਬੋਰ ਵਾਲੀਆਂ ਕਣਕ ਦੀਆਂ ਬੋਰ ਕਰਨ ਵਾਲੀਆਂ ਬਣਾਉਂਦਾ ਹੈ ਉਹ ਉਹ ਹੀ ਬਣਾ ਉਹ ਹੀ ਬਣਾ ਸਕਦਾ ਹੈ ਉਹ ਜਿਹੜੇ ਕੰਮ ਮੁੰਡੇ ਕੰਮ ਰੁਚੀ ਲਾ ਕੇ ਕਰਦੇ ਹਨ ਉਹਨਾਂ ਨੂੰ ਉਹੋ ਜਿਹਾ ਹੀ ਕੰਮ ਦਿੱਤਾ ਜਾਂਦਾ ਹੈ ਜਿਹੜਾ ਕੋਈ ਮੁਨੀਮ ਹੁੰਦਾ ਹੈ ਫੈਕਟਰੀਆਂ ਵਿੱਚ ਉਹਨੂੰ ਮੁਨੀਮੀ ਦਾ ਹੀ ਕੰਮ ਦਿੱਤਾ ਜਾਂਦਾ ਹੈ ਇਸ ਕਰਕੇ ਕਰਮ ਇਸ ਕਰਕੇ ਮੁੰਡਿਆਂ ਨੂੰ ਕੰਮ ਇਹ ਹੀ ਕਰਨਾ ਚਾਹੀਦਾ ਹੈ ਜਿਹੜਾ ਕਿ ਕੋਈ ਮਨ ਲਾ ਕੇ ਆਪਣਾ ਕੰਮ ਕਰੇ ਇਸ ਕਰਕੇ ਉਹ ਮੁੰਡੇ ਨੂੰ ਵੀ ਕੰਮ ਦਿੱਤਾ ਜਾਂਦਾ ਹੈ ਤਾਂ ਕਰ ਤਾਂ ਕਰਕੇ ਕਰ ਮੁੰਡੇ ਪੜ੍ਹੇ ਲਿਖੇ ਹੋਣੇ ਚਾਹੀਦੇ ਹਨ ਤਾਂ ਜਾ ਕੇ ਅਨਪੜ੍ਹ ਹਨ ਉਹਨਾਂ ਨੂੰ ਵੀ ਉਹੋ ਜਿਹਾ ਹੀ ਕੰਮ ਦਿੱਤਾ ਜਾਂਦਾ ਹੈ ਇਸ ਕਰਕੇ ਕਾਰੋਬਾਰ ਵਿੱਚ ਆਪਣੀ ਆਪ ਆਪ ਨੂੰ ਵਾਧਾ ਕਰਨਾ ਚਾਹੀਦਾ ਹੈ